ਬਰਤਨ ਧੋਣ ਦੀ ਪ੍ਰਕਿਰਿਆ ਇੱਕ ਆਸਾਨ ਪ੍ਰਕਿਰਿਆ ਹੈ ਬਰਤਨ ਧੁਖ ਧੋਣ ਲਈ ਪਹਿਲਾਂ ਬਰਤਨ ਨੂੰ ਸਾਫ਼ ਪਾਣੀ ਨਾਲ ਸਾਫ਼ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਜੋ ਵੀ ਉਸ ਬਰਤਨ ਧੋਣ ਵਾਲੀ ਸਾਬਣ ਜਾਂ ਬਰਤਨ ਧੋਣ ਵਾਲਾ ਸਰਫ ਜਾਂ ਜੇ ਜੇਸੇ ਪਿੰਡਾਂ ਦੇ ਵਿੱਚ ਸਵਾਹ ਨਾਲ ਵੀ ਬਰਤਨ ਮਾਂਜੇ ਜਾਂਦੇ ਨੇ ਉਹਨਾਂ ਨਾਲ ਸਭ ਸਾਫ਼ ਕੀਤਾ ਜਾਂਦਾ ਹੈ ਮਾਂਜਿਆ ਜਾਂਦਾ ਹੈ ਉਸ ਤੋਂ ਇਲਾਵਾ ਫਿਰ ਉਸ ਤੋਂ ਦੁਬਾਰਾ ਫਿਰ ਸਾਫ਼ ਪਾਣੀ ਵਿੱਚ ਪਾ ਕੇ ਬਾਹਰ ਕੱ ਬਾਹਰ ਕੱਢਿਆ ਜਾਂਦਾ ਹੈ ਅਤੇ ਉਸ ਤੋਂ ਉਸ ਤੋਂ ਫਿਰ ਅ ਅਲੱਗ ਫਿਰ ਖੱਪੇ ਨਾਲ ਸਾਫ਼ ਕਰਕੇ ਧ ਧਰਿਆ ਧਰਿਆ ਜਾਂਦਾ ਹੈ ਇਸ ਦੀ ਆਸਾਨ ਪ੍ਰਕਿਰਿਆ ਹੈ ਤੇਲ ਵਾਲੇ ਬਰਤਨਾਂ ਨੂੰ ਕਈ ਕਈ ਉਪਕਰਨਾਂ ਰਾਹੀਂ ਧੋਤਾ ਜਾਂਦਾ ਹੈ ਜਿਵੇਂ ਕਿ ਸਾਬਣ ਨਾਲ ਵੀ ਤੇਲ ਵਾਲੇ ਧੋਤੇ ਜਾਂਦੇ ਨੇ ਸਵਾਹ ਨਾਲ ਵੀ ਬਰਤਨ ਧੋਤੇ ਜਾਂਦੇ ਨੇ ਅਤੇ ਆਹ ਆਪਣਾ ਰੇਤਾ ਵੀ ਯੂਜ ਕੀਤਾ ਜਾਂਦਾ ਹੈ ਜੇ ਜ਼ਿਆਦਾ ਤੇਲ ਹਾਂ ਲੱਗੇ ਤਾਂ ਲੱਗਿਆ ਹੋਇਆ ਤਾਂ ਆਪਣਾ ਵਿਮ ਪਾਊਡਰ ਵਗੈਰਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਬਰਤਨ ਅਤੇ ਨੂੰ ਤੇਲ ਵਾਲੇ ਤੇਲ ਵਾਲੇ ਬਰਤਨ ਜਦੋਂ ਵੀ ਵਰਤਦੇ ਹਾਂ ਆਸਾਨੀ ਨਾਲ ਕਈ ਵਾਰੀ ਨਹੀਂ ਧੋਤੇ ਜਾਂਦੇ ਅਤੇ ਉਸ ਜਗ੍ਹਾ 'ਤੇ ਉਸ ਨੂੰ ਉਸਨੂੰ ਅ ਚੰਗੇ ਅ ਚੰਗੇ ਜਿਵੇਂ ਕੋਈ ਰੇਤਾ ਜਾਂ ਸੋ ਸਵਾਹ ਜਾਂ ਬਰੇਤੀ ਆਦਿ ਲਈ ਵੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਵੀਰਸੋਦ ਇਹ ਇਹ ਹੀ ਦੋ ਚਾਰ ਜਿਹੜੇ ਤਦ ਤਰੀਕੇ ਨਾਲ ਹੀ ਇਸ ਨੂੰ ਸਾਫ਼ ਕਰ ਸਾਫ਼ ਕਰਦੇ ਹਾਂ ਫਿਰ ਤੇਲ ਵਾਲੇ ਬਰਤਨਾਂ ਨੂੰ ਵੀ ਦੁਬਾਰਾ ਫਿਰ ਦੋ ਦੋ ਤਿੰਨ ਪ੍ਰਕਿਰਿਆ ਰਾਹੀਂ ਧੋ ਕੇ ਫਿਰ ਸਾਫ਼ ਪਾਣੀ ਨਾਲ ਧੋ ਕੇ ਅਤੇ ਕੱਪੜੇ ਰਾਹੀਂ ਇਸ ਨੂੰ ਸੁਕਾ ਕੇ ਨੇ ਵਰਤੋਂ ਵਿੱਚ ਲਿਆਉਣ ਯੋਗ ਬਣ ਜਾਂਦਾ ਹੈ ਇਹ ਸਾਰੀ ਪ੍ਰਕਿਰਿਆ ਦਾ ਮੂਲ ਢੰਗ ਇਹ ਹੀ ਹੈ ਅਤੇ ਉਸਦੇ ਇਹ ਹੀ ਬਹੁਤ ਸਾਫ਼ ਕਰਦੇ ਨੇ ਕਰ ਸਾਫ਼ ਸਫਾਈ ਦੇ ਰਹੀ ਇਹੀ ਤਰੀਕੇ ਵਰਤੋਂਯੋਗ ਵਿੱਚ ਆਉਂਦੇ ਹਨ